ਮੈਂ ਤਰਨ ਤਾਰਨ ਸਾਹਿਬ ਵਿਖੇ ਰਹਿੰਦੀ ਹਾਂ ਜੋ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਸੀ ਤਰਨਤਾਰਨ ਵਿਖੇ ਇੱਕ ਗੁਰਦੁਆਰਾ ਹੈ ਦਰਬਾਰ ਸਾਹਿਬ ਜੋ ਕਿ ਗੁਰੂ ਅਰਜਨ ਦੇਵ ਜੀ ਦੇ ਨਾਮ ਤੋਂ ਹੈ ਇੱਥੇ ਤਰਨਤਾਰਨ ਸਾਹਿਬ ਦਾ ਸਰੋਵਰ ਸਭ ਤੋਂ ਵੱਡਾ ਸਰੋਵਰ ਹੈ ਜਿੱਥੇ ਕਿ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆ ਕੇ ਮੱਥਾ ਟੇਕਦੇ ਹਨ ਮੈਂ ਬਹੁਤ ਮਾਨ ਮਹਿਸੂਸ ਕਰਦੀ ਹਾਂ ਕਿ ਮੈਂ ਤਰਨ ਤਾਰਨ ਸਾਹਿਬ ਦੇ ਵਿੱਚ ਰਹਿੰਦੀ ਹਾਂ ਤਰਨਤਾਰਨ ਸਾਹਿਬ ਵਿਖੇ ਲੋਕ ਮੱਸਿਆ 'ਤੇ ਸੰਗਰਾਂਦ ਸੰਗਰਾਂਦ 'ਤੇ ਇਸ਼ਨਾਨ ਕਰਨ ਅਤੇ ਮੱਥਾ ਟੇਕਣ ਆਉਂਦੇ ਆ ਕੋਈ ਵੀ ਗੁਰੂ ਦਾ ਜਨਮ ਦਿਹਾੜਾ ਹੁੰਦਾ ਉਹ ਵੀ ਇੱਥੇ ਧੂਮਧਾਮ ਨਾਲ ਮਨਾਇਆ ਜਾਂਦਾ ਵਾ ਜਦੋਂ ਕ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਦਿਹਾੜਾ ਹੁੰਦਾ ਗੁਰਪੂਰਬ ਹੁੰਦਾ ਉਹ ਇੱਥੇ ਬਹੁਤ ਹੀ ਸ਼ਰਧਾ ਅਤੇ ਮਾਨ ਸਤਿਕਾਰ ਦੇ ਨਾਲ ਮਨਾਇਆ ਜਾਂਦਾ ਵਾ ਬਹੁਤ ਹੀ ਵਧ ਵਧੀਆ ਤਰੀਕੇ ਦੇ ਨਾਲ ਸ਼ਰਧਾ ਦੇ ਨਾਲ ਲੋਕ ਆਉਂਦੇ ਹਨ ਅਤੇ ਮੱਥਾ ਟੇਕਦੇ ਹਨ ਸੇਵਾ ਕਰਦੇ ਹਨ ਤਰਨਤਾਰਨ ਸਾਹਿਬ ਵਿਖੇ ਦੇ ਲਾਗੇ ਹੀ ਇੱਕ ਅੰਮ੍ਰਿਤਸਰ ਹੈ ਜਿੱਥੇ ਕਿ ਹਰਿਮੰਦਰ ਸਾਹਿਬ ਹੈ ਰਾਮਦਾਸ ਜੀ ਦੇ ਨਾਮ ਦੇ ਉੱਪਰ ਗੁਰਦੁਆਰਾ ਹੈ ਜਿਹਨੂੰ ਕਿ ਗੋਲਡਨ ਟੈਂਪਲ ਕਿਹਾ ਜਾਂਦਾ ਹੈ ਉੱਥੇ ਵੀ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆ ਕੇ ਮੱਥਾ ਟੇਕਦੇ ਹਨ ਜਿਹਦੇ ਕਿ ਜੋ ਕਿ ਇੱਕ ਸਰੋਵਰ ਦੇ ਅੰਦਰ ਬਣਾਇਆ ਗਿਆ ਹੈ